ਮੈਂ ਆਪਣੀ ਚੜ੍ਹਨ ਦੇ ਸੁ ਚੜ੍ਹਨ ਦੇ ਹੁਨਰ ਨੂੰ ਸੁਧਾਰਨ ਲਈ ਆਪਣੇ ਆਪ ਨੂੰ ਪ੍ਰੇਰਿਤ ਜਿਨ੍ਹਾਂ ਨੇ ਪਹਿਲਾਂ ਵੱਡੀਆਂ ਵੱਡੀਆਂ ਚੜ੍ਹਾਈਆਂ ਵੱਡੇ ਵੱਡੇ ਪਹਾੜ ਚੜ੍ਹੇ ਹੋਏ ਨੇ ਉਹਨਾਂ ਦਾ ਇਤਿਹਾਸ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਮੈਂ ਆਪਣੇ ਆਪ ਨੂੰ ਪ੍ਰੇਰਿਤ ਰੱਖਦਾ ਹਾਂ ਅਤੇ ਮੈਂ ਹੋਰ ਵੀ ਬਹੁਤ ਕੁਝ ਜਾਣਨਾ ਚਾਹੁੰਦਾ ਹਾਂ ਕਿ ਕੀ ਕੀ ਮੁਸ਼ਕਲਾਂ ਆਉਂਦੀਆਂ ਹਨ ਚੜ੍ਹਾਈ ਚੜ੍ਹਨ 'ਤੇ ਓਕੇ ਧੰਨਵਾਦ